ਮੈਂ ਬੁਸ਼ਰਾ ਬਾਤ ਕਰ ਰਹੀ ਆ ਤੁਹਾਡੀ ਗੁ ਤੁਹਾਡੀ ਗੁਆਂਢਣ ਮੈਨੂੰ ਜੁੱਤੀ ਅਤੇ ਫੁੱਲਕਾਰੀ ਚੁੰਨੀ ਲੈਣੀ ਸੀ ਮਤਲਬ ਉਹ ਕਿੱਥੋ ਮਿਲਦੀ ਹੈ ਸਭ ਤੋਂ ਵਧੀਆ ਅੱਛਾ ਜੀ ਅਤੇ ਕਿੰਨੇ ਮਤਲਬ ਕਿੰਨੇ ਦੂਰ ਹੋਣੇ ਇਹ ਅਤੇ ਉੱਥੇ ਮਤਲਬ ਕਿੰਨੀ ਮਤਲਬ ਪ੍ਰਾਈਜ਼ ਕਿੰਨੀ ਹੋਣੀ ਜੁੱਤੀ ਦੀ ਅੱਛਾ

ਇੱਥੇ ਕੋਈ ਨਜ਼ਦੀਕ ਨਵਾਂ ਸ਼ਹਿਰ 'ਚ ਦੁਕਾਨ ਨੀ ਹੈਗੀ ਫੁੱਲਕਾਰੀ ਦੀ ਹਾਂਜੀ ਅਤੇ ਉੱਥੇ ਵੀ ਉਨ੍ਹੀ ਉੱਥੇ ਵੀ ਸਸਤੀ ਪੈਣੀ ਜਾਂ ਮਹਿੰਗੀ ਪੈਣੀ ਉੱਥੇ ਦਾ ਟੋਟਲ ਖ਼ਰਚ ਕਿੰਨਾਂ ਆਉਣਾ ਜ਼ਿਆਦਾ ਖ਼ਰਚ ਆਉਣਾ ਜਾਂ ਘੱਟ ਆਉਣਾ ਇੱਕ ਹਜ਼ਾਰ 'ਚ ਆਜੂਗੀ ਜੁੱਤੀ ਅੱਛਾ ਜੀ ਅੱਛਾ ਜੀ ਅਤੇ ਜੁੱਤੀਆਂ ਕਿੰਨੀ ਮਤਲਬ ਕਿੰਨੇ ਕਲਰ ਦੇ ਵਿੱਚ ਮਿਲ ਜਾਂਦੀਆਂ ਕਢਾਈ ਵਾਲੀ ਜੁੱਤੀਆਂ ਮਿਲ ਜਾਣੀ ਹਾਂਜੀ ਹਾਂਜੀ ਹਾਂਜੀ ਅਤੇ ਉਹਨਾਂ ਦਾ ਪ੍ਰਾਈਜ਼ ਕਿੰਨਾਂ ਹੋਣਾ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ ਜੀ ਠੀਕ ਹੈ